ਪੰਜਾਬ ਦੇ ਇਤਿਹਾਸ ਨੂੰ ਜੇਕਰ ਸਭ ਤੋਂ ਵੱਡਾ ਆਕਾਰ ਦਿੱਤਾ ਉਹ ਸਿੱਖ ਇਤਿਹਾਸ ਨੇ ਦਿੱਤਾ ਜਿਵੇਂ ਆਪਾਂ ਗੱਲ ਕਰੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਸੋਲ੍ਹਾਂ ਸੋ ਨੜਿਨਵੇਂ ਈਸਵੀ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿਸ ਨੇ ਕੀ ਕਰਿਆ ਮਜ਼ਲੂਮਾਂ ਦੀ ਰੱਖਿਆ ਕੀਤੀ ਤਾਂ ਪੰਜਾਬ ਦੇ ਵਿੱਚ ਜਿਹੜੇ ਮਜ਼ਲੂਮ ਸੀਗੇ ਜਿਹੜੇ ਕਦੇ ਵੀ ਮੁਗਲਾਂ ਦੇ ਸਾਹਮਣੇ ਸਿਰ ਨਹੀਂ ਚੁੱਕ ਸਕੇ ਸੀ ਉਹ ਸ਼ੇਰ ਬਣ ਕੇ ਖੜ੍ਹ ਗਏ ਅਤੇ ਉਹਨਾਂ ਨੇ ਪੰਜਾਬ ਦੇ ਇਤਿਹਾਸ ਨੂੰ ਇੱਕ ਪੂਰੀ ਵਲਡ ਦੇ ਵਿੱਚ ਫੇਮਸ ਕੀਤਾ ਜਿਵੇਂ ਕਿ ਪੰਜਾਬ ਦੇ ਇਤਿਹਾਸ ਨੂੰ ਉਹ ਆਕਾਰ ਦੇਣ ਵਾਲੇ ਬਹੁਤ ਸਾਰੇ ਜਿਵੇਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਕਿਹਾ ਜਾਂਦਾ ਜਿਹਨੂੰ ਜਿੱਥੇ ਹਰ ਵਕਤ ਪਰਮਾਤਮਾ ਦੀ ਆਵਾਜ਼ ਗੂੰਜਦੀ ਹੈ ਤਾਂ ਬਹੁਤ ਆਪਾਂ ਕਹਿ ਦਈਏ ਇੰਟਰਨੈਸ਼ਨਲ ਲੋਕ ਉੱਥੇ ਆਉਂਦੇ ਨੇ ਅਤੇ ਉਹਨਾਂ ਨੂੰ ਬੜਾ ਸਕੂਨ ਮਿਲਦਾ ਦੋ ਨੰਬਰ 'ਤੇ ਉਹ ਤੋਂ ਬਾਅਦ ਜਲਿਆਂਵਾਲਾ ਬਾਗ ਜਿਸ ਨੇ ਵੀ ਪੰਜਾਬ ਦੇ ਇਤਿਹਾਸ ਨੂੰ ਅਕਾਰ ਦਿੱਤਾ ਗਾ ਜਿੱਥੇ ਜਰਨਲ ਡਾਇਰ ਨੇ ਲੋਕਾਂ ਦੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ ਮਹਾਰਾਜਾ ਰਣਜੀਤ ਸਿੰਘ ਮਿਊਜ਼ਅਮ ਜੋ ਵੀ ਇਤਿਹਾਸ ਦੇ ਵਿੱਚ ਮਹੱਤਵ ਸਥਾਨ ਰੱਖਦਾ ਵਾਘਾ ਬਾਰਡਰ ਮਹਾਰਾਜਾ ਰਣਜੀਤ ਸਿੰਘ ਬਾਰ ਮਿਊਜ਼ਅਮ ਗੁਰਦੁਆਰਾ ਮਾਤਾ ਕੌਲਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਅਕਾਰ ਦਿੱਤਾ